ਪੰਜਾਬ ਦੇ ਵਿੱਚ ਸਥਾਨਕ ਵਪਾਰਕ ਭਾਈਚਾਰਾ ਇੱਕ ਦੂਜੇ ਦੀ ਬਹੁਤ ਮਦਦ ਕਰਦਾ ਕਿਸੇ ਨੇ ਇੱਕ ਫੈਕਟਰੀ ਲਗਾਈ ਹੈ ਉਹ ਫੈਕਟਰੀ ਦੇ ਵਿੱਚ ਉਹਨੂੰ ਕੱਚਾ ਮਟੀਰੀਅਲ ਚਾਹੀਦਾ ਕੁਛ ਚੀਜ਼ ਬਣਾਉਣ ਵਾਸਤੇ ਤਾਂ ਉਹ ਕੱਚਾ ਮਟੀਰੀਅਲ ਕਿਹਦੇ ਤੋਂ ਲੈਣਾ ਇਹ ਭਾਈਚਾਰੇ ਕਰਕੇ ਬਹੁਤ ਸੌਖਾ ਹੋ ਜਾਂਦਾ ਉਹ ਕੱਚਾ ਮਟੀਰੀਅਲ ਕਿਸੇ ਤੋਂ ਲਿਆ ਕੋਈ ਇੱਕ ਉਹਨੇ ਛੋਟਾ ਜਿਹਾ ਪ੍ਰੋਡਕਟ ਬਣਾਇਆ ਜੋ ਜਿਵੇਂ ਗੱਡੀ ਦੇ ਵਿੱਚ ਵਰਤੋਂ ਦੇ ਵਿੱਚ ਆਉਣਾ ਤਾਂ ਜੋ ਗੱਡੀ ਦੀ ਮੈਨਫੈਕਚਰਿੰਗ ਕਰ ਰਿਹਾ ਉਹ ਉਸ ਇਨਸਾਨ ਕੋਲ ਜਾਵੇਗਾ ਜਿਸਨੇ ਉਹ ਛੋਟਾ ਜਿਹਾ ਪਾਰਟ ਬਣਾਇਆ ਉਸ ਤੋਂ ਉਹ ਪਾਰਟ ਲਵੇਗਾ ਇੱਦਾਂ ਹੀ ਉਹ ਬਹੁਤ ਸਾਰੀਆਂ ਥਾਵਾਂ ਤੋਂ ਛੋਟੇ ਛੋਟੇ ਪਾਰਟਸ ਚੀਜ਼ ਦੇ ਇਕੱਠੇ ਕਰਕੇ ਇੱਕ ਵਧੀਆ ਗੱਡੀ ਦਾ ਉਤਪਾਦਨ ਕਰ ਸਕਦਾ ਅਤੇ ਉਸਨੂੰ ਫਿਰ ਉਹਨੇ ਵੇਚਣਾ ਤਾਂ ਉਹ ਮਾਰਕੀਟਿੰਗ ਵਾਸਤੇ ਕਿਸੇ ਨਾ ਕਿਸੇ ਕੋਲ ਜਾਵੇਗਾ ਜਿਵੇਂ ਅੱਜ ਸੋਸ਼ਲ ਮੀਡੀਆ ਬਹੁਤ ਵਰਤਿਆ ਜਾ ਰਿਹਾ ਮਾਰਕੀਟਿੰਗ ਵਾਸਤੇ ਇਸਟਾਗਰਾਮ ਦੇ ਉੱਤੇ ਜੋ ਇਨਫਲੈਂਸਰ ਨੇ ਉਹਨਾਂ ਦੀ ਮਦਦ ਨਾਲ ਉਹ ਚੀਜ਼ ਨੂੰ ਉਹ ਮਾਰਕੀਟ ਦੇ ਵਿੱਚ ਪੇਸ਼ ਕਰ ਸਕਦਾ ਤਾਂ ਕਿ ਉਸਦਾ ਵੱਧ ਤੋਂ ਵੱਧ ਵਿਕਰੀ ਹੋ ਸਕੇ ਐਵੇਂ ਹੀ ਇਹ ਭਾਈਚਾਰੇ ਦੇ ਵਿੱਚ ਇੱਕ ਦੂਜੇ ਨਾਲ ਹੱਥ ਨਾਲ ਹੱਥ ਜੋੜ ਕੇ ਜਦੋਂ ਆਪਾਂ ਖੜ ਜਾਂਦੇ ਹਾਂ ਤਾਂ ਆਪਣੀਆਂ ਜਿਹੜੀਆਂ ਜਰੂਰਤਾਂ ਨੇ ਉਹ ਬੜੀਆਂ ਆਸਾਨ ਹੋ ਜਾਂਦੀਆਂ ਪੂਰੀਆਂ ਹੋਣੀਆਂ ਅਤੇ ਜਿਸ ਦੇ ਨਾਲ ਉਤਪਾਦਨ ਦੇ ਵਿੱਚ ਸਭ ਤੋਂ ਵੱਧ ਵਾਧਾ ਹੁੰਦਾ ਕਿਸੇ ਨੂੰ ਕੋਈ ਪੈਸੇ ਦੀ ਲੋੜ ਹੁੰਦੀ ਹੈ ਤਾਂ ਉਹ ਇੱਕ ਦੂਜੇ ਨਾਲ ਇੱਦਾਂ ਹੀ ਵਧੀਆ ਬਣਾਏ ਹੋਏ ਰਿਲੇਸ਼ਨਾਂ ਕਰਕੇ ਰਿਸ਼ਤਿਆਂ ਕਰਕੇ ਉਹ ਚੀਜ਼ ਉਸਨੂੰ ਆਸਾਨ ਹੋ ਜਾਂਦੀ ਹੈ